ਹਾਂਜੀ ਬੇਨਤੀ ਹੈ ਕਿ ਮੈਂ ਆਪ ਜੀ ਦੀ ਕੰਪਨੀ ਦਾ ਜੋ ਬਰਾਡਬੈਂਡ ਹੈ ਉਸਦੀ ਵਰਤੋਂ ਕਰ ਰਿਹਾ ਹਾਂ ਕਿਉਂਕਿ ਮੈਨੂੰ ਆਪਣੀ ਸਰਵਿਸ ਦੇ ਦੌਰਾਨ ਅਤੇ ਹਰ ਉਹ ਆਪਣੀ ਬੇਟੀ ਦੀ ਸਟੱਡੀ ਅਤੇ ਹੋਰ ਅਨੇਕਾਂ ਕੰਮਾਂ ਦੇ ਲਈ ਜੋ ਹੈ ਵਾਈਫਾਈ ਜਾਂ ਬਰੋਡਬੈਂਡ ਦੀ ਕਾਫੀ ਜ਼ਰੂਰਤ ਪੈਂਦੀ ਹੈ ਅਤੇ ਹੁਣ ਵਧੀਆਂ ਹੋਈਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਮੇਰੀ ਬਰੋਡਬੈਂਡ ਦੀ ਵਰਤੋਂ ਹੈ ਉਹ ਕਾਫੀ ਵਰਤੋਂ ਜ਼ਿਆਦਾ ਹੋਣ ਲਈ ਹੈ ਅਤੇ ਬੇਟੀ ਨੂੰ ਸਟੱਡੀ ਦੇ ਵਿੱਚ ਵੀ ਬਰੋਡਬੈਂਡ ਦੀ ਜ਼ਰੂਰਤ ਵਧਣ ਕਰਕੇ ਮੈਂ ਆਪਣੀ ਉਸਨੂੰ ਇਸਦੇ ਅਨੁਕੂਲ ਬਣਾਉਣਾ ਚਾਹੁੰਦਾ ਹਾਂ ਭਾਵ ਜੋ ਆਪਣੀ ਬਰੋਡਬੈਂਡ ਪਲੈਨ ਚੱਲ ਰਿਹਾ ਹੈ ਮੇਰਾ ਯੋਜਨਾ ਉਸ ਨੂੰ ਮੈਂ ਉੱਚ ਗਤੀ ਹਾਈ ਸਪੀਡ ਦੇ ਵਿੱਚ ਅਪਗ੍ਰੇਡ ਕਰਨ ਬਾਰੇ ਸੋਚ ਰਿਹਾ ਹਾਂ ਸੋ ਕਿਰਪਾ ਕਰਕੇ ਮੈਨੂੰ ਆਪਣੀ ਇਸ ਕੰਪਨੀ ਦੇ ਵਿੱਚ ਹੀ ਮੈਂ ਜੋ ਹਾਈ ਸਪੀਡ ਪ੍ਰਾਪਤ ਕਰਨਾ ਚਾਹੁੰਦਾ ਹਾਂ ਤਾਂ ਕਿਰਪਾ ਕਰਕੇ ਕੀ ਤੁਸੀਂ ਕੁਝ ਸਮਾਂ ਕੱਢ ਕੇ ਮੈਨੂੰ ਆਪਣੇ ਮੌਜੂਦਾ ਜੋ ਬਰੋਡਬੈਂਡ ਪਲਾਨ ਨੇ ਯੋਜਨਾ ਹੈ ਉਸ ਬਾਰੇ ਮੇਰੀ ਵੱਧਦੀ ਹੋਈ ਜੋ ਵਰਤੋਂ ਹੈ ਉਸਦੇ ਅਨੁਸਾਰ ਮੈਂ ਜੋ ਹਾਈ ਸਪੀਡ ਲੈਣਾ ਚਾਹੁੰਦਾ ਹਾਂ ਕੀ ਤੁਸੀਂ ਉਸ ਬਾਰੇ ਮੈਨੂੰ ਕੁਝ ਜਾਣਕਾਰੀ ਜੋ ਹੈ ਪ੍ਰਦਾਨ ਕਰ ਸਕਦੇ ਹਾਈ ਸਪੀਡ ਨਾਲ ਮੈਨੂੰ ਉੱਚ ਗਤੀ ਜੋ ਹੈ ਉਹ ਪ੍ਰਾਪਤ ਕਰਨ ਦੇ ਵਿੱਚ ਮੇਰਾ ਕਿੰਨਾ ਹੋਰ ਖਰਚਾ ਵਧੇਰੇ ਆ ਸਕਦਾ ਹੈ ਉਸ ਵਿੱਚ ਮੈਨੂੰ ਹਾਈ ਸਪੀਡ ਹੋਰ ਜਿਹੜੀ ਹੈ ਕਿੰਨੀ ਤੁਸੀਂ ਦੇ ਸਕਦੇ ਹੋ ਅਤੇ ਇਸ ਸਾਰੇ ਕਿਰਿਆ ਦੇ ਵਿੱਚ ਪ੍ਰੋਸੈਸ ਦੇ ਵਿੱਚ ਮੈਨੂੰ ਕਿੰਨਾ ਸਮਾਂ ਉਡੀਕ ਕਰਨੀ ਪਵੇਗੀ ਤਾਂ ਕਿ ਮੈਂ ਜੋ ਆਪਣੀ ਬਰੋਡਬੈਂਡ ਯੋਜਨਾ ਦਾ ਜਿਹੜਾ ਲਾਭ ਹੈ ਉਹ ਉਠਾ ਸਕਾਂ ਸੋ ਕਿਰਪਾ ਕਰਕੇ ਮੈਨੂੰ ਜੋ ਬਰੋਡਬੈਂਡ ਯੋਜਨਾ ਨੂੰ ਹਾਈ ਸਪੀਡ ਵਿੱਚ ਅਪਗਰੇਡ ਬਾਰੇ ਜਾਣਕਾਰੀ ਦੇਣ ਵਿੱਚ ਮੇਰਾ ਮਾਰਗਦਰਸ਼ਨ ਕਰਨ ਵਿਚ ਕਿਰਪਾ ਕਰਕੇ ਮੇਰੀ ਜੋ ਹੈ ਸਹਾਇਤਾ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਧੰਨਵਾਦ